ਹੈਲੋ ਹਾਂਜੀ ਤੁਸੀਂ ਸਵੀਗੀ ਤੋਂ ਗੱਲ ਕਰ ਰਹੇ ਹੋ ਮੈਂ ਜੀ ਇੱਕ ਔਡਰ ਦੇ ਰਹੀ ਹਾਂ ਮੇਰੇ ਔਡਰ ਦੇ ਵਿੱਚ ਮੈਂ ਪਾਸਤਾ ਬਰਗਰ ਪੀਜ਼ਾ ਮੰਗਵਾਉਣਾ ਚਾਹੁੰਦੀ ਹਾਂ ਮੈਂ ਚਾਹੁੰਦੀ ਹਾਂ ਕਿ ਮੇਰਾ ਖਾਣਾ ਮੇਰੇ ਤੱਕ ਪਹੁੰਚਣ 'ਤੇ ਗਰਮ ਅਤੇ ਤਾਜ਼ਾ ਰਹੇ ਕਈ ਵਾਰੀ ਕੀ ਹੁੰਦਾ ਹੈ ਕਿ ਸੜਕ ਦੇ ਵਿੱਚ ਕਾਫ਼ੀ ਆਵਾਜਾਈ ਹੋਣ ਕਰਕੇ ਅਤੇ ਟਰੈਫਿਕ ਲਾਈਟਾਂ ਹੋਣ ਕਰਕੇ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ ਡਿਲੀਵਰੀ ਵਾਲਾ ਬੰਦਾ ਸਾਡੇ ਤੱਕ ਪਹੁੰਚਣ ਦੇ ਵਿੱਚ ਦੇਰ ਹੋ ਜਾਂਦਾ ਹੈ ਅੱਜ ਕੱਲ੍ਹ ਸਰਦੀਆਂ ਦੇ ਮੌਸਮ ਦੇ ਵਿੱਚ ਧੁੰਦ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਜੋ ਖਾਣਾ ਆਉਂਦਾ ਹੈ ਸਾਡੇ ਤੱਕ ਉਹ ਗਰਮ ਨਹੀਂ ਪਹੁੰਚਦਾ ਤਾਂ ਮੈਂ ਤੁਹਾਨੂੰ ਇੱਕ ਸਲਾਹ ਦੇਣਾ ਚਾਹੁੰਦੀ ਹਾਂ ਕਿ ਖਾਣੇ ਨੂੰ ਵਧੀਆ ਤਰੀਕੇ ਦੀ ਪੈਕੇਜਿੰਗ ਵਿੱਚ ਪੈਕ ਕਰਕੇ ਸਾਡੇ ਤੱਕ ਪਹੁੰਚਾਇਆ ਜਾਵੇ ਜਿਸ ਕਰਕੇ ਕਿ ਸਾਨੂੰ ਕੋਈ ਸਾਹਮਣਾ ਨਾ ਕਰਨਾ ਪਵੇ ਅਸੀਂ ਤਾਜਾ ਅਤੇ ਵਧੀਆ ਗਰਮ ਖਾਣਾ ਖਾ ਸਕੀਏ ਮੈਂ ਤੁਹਾਨੂੰ ਇਹ ਸਲਾਹ ਦੇਣਾ ਚਾਹੁੰਦੀ ਹਾਂ ਕਿ ਖਾਣੇ ਨੂੰ ਤੁਸੀਂ ਵਧੀਆ ਪੈਕੇਜਿੰਗ ਦੇ ਵਿੱਚ ਪੈਕ ਕਰੋ ਜਿੱਦਾਂ ਕਿ ਆਈਸੋਲੇਟਿਡ ਬੈਗ ਦੇ ਵਿੱਚ ਜਾਂ ਕੰਟੇਨਰ ਦੀ ਵਰਤੋਂ ਕਰੋ ਜਿਸ ਨਾਲ ਖਾਣਾ ਸਾਡੇ ਤੱਕ ਗਰਮ ਅਤੇ ਤਾਜ਼ਾ ਰਹੇ ਧੰਨਵਾਦ